ਹੈਲੋ ਹਾਂਜੀ ਭਾ ਜੀ ਮੈਂ ਨਿਰਮਲ ਸਿੰਘ ਬੋਲ ਰਿਐਂ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਮੈਨੂੰ ਨਾ ਤੁਹਾਡੇ ਬਾਰੇ ਪਤਾ ਲੱਗਿਆ ਕਿ ਤੁਸੀਂ ਗਾਈਡ ਐਂ ਪੰਜਾਬ ਦੇ ਵਿੱਚ ਮਤਲਬ ਵੱਖ ਵੱਖ ਥਾਵਾਂ 'ਤੇ ਘੁਮਾ ਦਿੰਨੇ ਐਂ ਟੂਰੀਸ਼ ਦਾ ਕੰਮ ਹੈ ਤੁਹਾਡਾ ਹਾਂਜੀ ਭਾ ਜੀ ਮੈਂ ਪੰਜਾਬ ਘੁੰਮਣਾ ਚਾਹੁੰਦਾ ਹੈਗਾ ਮਤਲਬ ਵਧੀਆ ਵਧੀਆ ਥਾਵਾਂ 'ਤੇ ਮੈਂ ਜਿੱਥੇ ਵੀ ਆਪਣੇ ਕੋਈ ਇਤਿਹਾਸਿਕ ਸਥਾਨ ਹੋਏ ਜਾਂ ਟਿਊਰਿਸਟ ਹੋਏ ਇੱਦਾਂ ਦੀਆਂ ਥਾਵਾਂ 'ਤੇ ਘੁੰਮਣਾ ਚਾਹੁੰਦਾ ਅਤੇ ਆਪਣਾ ਤੁਸੀਂ ਮੈਨੂੰ ਦੱਸੋ ਜੀ ਉਹਦੇ ਬਾਰੇ ਵੀ ਕਿਆ ਤੁਹਾਡਾ ਚਾਰਜ ਜਾਂ ਕਿਆ ਸਿਸਟਮ ਹੈ ਜੀ ਤੁਹਾਡਾ ਘੁਮਾਉਣ ਦਾ ਇੱਥੇ

ਹਾਂਜੀ ਅਜ ਅਜਾਇਬ ਘਰ ਹਾਂਜੀ ਅੱਛਾ ਜੀ ਠੀਕ ਹੈ ਜੀ ਫੈਮਲੀ ਨਾਲ ਹੈ ਜੀ ਸਾਨੂੰ ਸੱਤ ਸੀਟਰ ਗੱਡੀ ਚਾਹੀਦੀ ਹੈ ਘੱਟੋ ਘੱਟ ਅੱਛਾ ਜੀ ਹਾਂਜੀ ਅੱਛਾ ਜੀ ਠੀਕ ਆ ਜੀ ਹਾਂਜੀ ਹਾਂਜੀ